ਮੈਨੂੰ ਫੋਟੋਗ੍ਰਾਫੀ ਦਾ ਬਹੁਤ ਹੀ ਜ਼ਿਆਦਾ ਸ ਸ਼ੌਂਕ ਹੈ ਅਤੇ ਨਾਲ ਹੀ ਮੈਂ ਟੂਰਿਸਟ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਘੁੰਮਣ ਦਾ ਮੈਂ ਇੱਕ ਵਾਰ ਕਸ਼ਮੀਰ ਗਿਆ ਸਾਂ ਤਾਂ ਉੱਥੇ ਮੈਂ ਬਹੁਤ ਸਾਰੀਆਂ ਫੋਟੋਗ੍ਰਾਫੀ ਕੀਤੀਆਂ ਉਹਨਾਂ ਵਿੱਚੋਂ ਇੱਕ ਮੈਨੂੰ ਬਹੁਤ ਹੀ ਮਨ ਪਸੰਦ ਮੇਰੀ ਫੋਟੋਗ੍ਰਾਫੀ ਹੈ ਅਤੇ ਹਮੇਸ਼ਾਂ ਉਹ ਪਲ ਹਮੇਸ਼ਾਂ ਮੈਨੂੰ ਯਾਦ ਰਹਿੰਦੇ ਹਨ ਉਸ ਸਮੇਂ ਦੀ ਫੋਟੋ ਹੈ ਜਦੋਂ ਮੈਂ ਇੱਕ ਛੋਟੀ ਜਿਹੀ ਬੱਚੀ ਨੂੰ ਕੁਝ ਵੇਚਦੇ ਵੇਖਿਆ ਸ਼ਾਮਾਂ ਦਾ ਟਾਈਮ ਸੀ ਤਾਂ ਜਦੋਂ ਉਸ ਦੀ ਫੋਟੋ ਕਲਿੱਕ ਕੀਤੀ ਤਾਂ ਸੂਰਜ ਉਸ ਸਮੇਂ ਛਿਪ ਰਿਹਾ ਸੀ ਅਸਮਾਨ ਦੇ ਵਿੱਚ ਕੁਝ ਨੀਲਾ ਅਸਮਾਨ ਕੁਝ ਖੱਟਾ ਅਸਮਾਨ ਅਤੇ ਕੁਝ ਕੁ ਹਨੇਰਾ ਹੋ ਰਿਹਾ ਸੀ ਅਤੇ ਉਸ ਬੱਚੀ ਦੀ ਫੋਟੋ ਵੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਤਰਸ ਆਉਂਦਾ ਅਤੇ ਉਸ ਦੀ ਜਦੋਂ ਮੈਂ ਕਹਾਣੀ ਸੁਣੀ ਤਾਂ ਅੱਜ ਵੀ ਮੇਰਾ ਮਨ ਉੱਥੇ ਪਹੁੰਚ ਜਾਂਦਾ ਹੈ ਕਿ ਉਹ ਬੱਚੀ ਕਿਵੇਂ ਆਪਣੇ ਪੇਟ ਵਾਸਤੇ ਰੁਜ਼ਗਾਰ ਕਰ ਰਹੀ ਹੈ ਅਤੇ ਉਸ ਦੇ ਸਿਰ ਉੱਤੇ ਉਸਦੇ ਪਿਤਾ ਜੀ ਨਹੀਂ ਹਨ ਅਤੇ ਉਹ ਆਪਣੀ ਮਾਂ ਦੇ ਨਾਲ ਸਮਾਨ ਵੇਚ ਕੇ ਘਰ ਦਾ ਗੁਜ਼ਾਰਾ ਬਤੀਤ ਕਰਦੀ ਸੀ ਅਤੇ ਉਹ ਸਕੂਲ ਦੇ ਵਿੱਚ ਵੀ ਨਹੀਂ ਸੀ ਪੜ੍ਹਦੀ ਘਰ ਦੀ ਮਜਬੂਰੀ ਦੇ ਕਾਰਨ ਉਸ ਨੂੰ ਇਹ ਕੰਮ ਕਰਨਾ ਪੈਂਦਾ ਸੀ ਉਹ ਫੋਟੋ ਲੈ ਕੇ ਮੇਰੇ ਮਨ ਦੇ ਵਿੱਚ ਅੱਜ ਵੀ ਉਹ ਹਾਲਾਤ ਪੈਦਾ ਹੋ ਜਾਂਦੇ ਹਨ ਜਿਹੜੇ ਉਸ ਦੇ ਨਾਲ ਮੈਂ ਵਰਣਨ ਕੀਤੇ ਹਨ